ਅੱਜ ਕੱਲ੍ਹ ਵੱਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨ ਬਹੁਤ ਵਿਹਲੇ ਫਿਰ ਰਹੇ ਹਨ ਜਿਸ ਕਾਰਨ ਉਹ ਮਾੜੀ ਸੰਗਤ ਦਾ ਅਤੇ ਮਾੜੇ ਕੰਮਾਂ ਦਾ ਸ਼ਿਕਾਰ ਹੁੰਦੇ ਹਨ ਅਤੇ ਬੇਰੁਜ਼ਗਾਰੀ ਕਾਰਨ ਨੌਜਵਾਨ ਨਸ਼ੇ ਵਿੱਚ ਜਾਂਦੇ ਹਨ ਅਤੇ ਅਤੇ ਜਿਸ ਕਾਰਨ ਉਹਨਾਂ ਦਾ ਅਤੇ ਉਹਨਾਂ ਦੇ ਮਾਂ ਪਿਉ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਸਰਕਾਰ ਨੂੰ ਵੀ ਅਹਿਮ ਕਦਮ ਉਠਾਉਣੇ ਚਾਹੀਦੇ ਹਨ ਵੀ ਬੇਰੁਜ਼ਗਾਰੀ ਨੂੰ ਵੱਧ ਤੋਂ ਵੱਧ ਖਤਮ ਕਰਨ ਸਰਕਾਰ ਨੂੰ ਨਵੇਂ ਤਰੀਕੇ ਅਪਣਾਉਣੇ ਚਾਹੀਦੇ ਹਨ ਜਿਸ ਕਾਰਨ ਬੇਰੁਜ਼ਗਾਰੀ ਖਤਮ ਹੋ ਸਕੇ ਅਤੇ ਨੌਜਵਾਨਾਂ 'ਚ ਵੀ ਵੀ ਕੰਮ ਕਰਨ ਦੀ ਚਾਹਤ ਵਧੇ ਸਰਕਾਰ ਨੂੰ ਨਵੇਂ ਪਲਾਂਟ ਲਾਉਣੇ ਚਾਹੀਦੇ ਹਨ ਨਵੀਆਂ ਫੈਕਟਰੀਆਂ ਲਗਾਉਣੀਆਂ ਚਾਹੀਦੀਆਂ ਹਨ ਅਤੇ ਜਿਹੜੀਆਂ ਖਾਲੀ ਪਈਆਂ ਪੋਸਟਾਂ ਨੇ ਉਹ ਭਰਨੀਆਂ ਚਾਹੀਦੀਆਂ ਹਨ ਜਿਸ ਕਾਰਨ ਨੌਜਵਾਨ ਬੇਰੁਜ਼ਗਾਰੀ ਤੋਂ ਛੁਟਕਾਰਾ ਪਾਉਣ ਅਤੇ ਜਦੋਂ ਨੌਜਵਾਨਾਂ ਕੋਲ ਪੈਸੇ ਨਹੀਂ ਹੁੰਦੇ ਤਾਂ ਫਿਰ ਉਹ ਆਪਣੇ ਮਾਂ ਪਿਉ ਦਾ ਇਲਾਜ ਵੀ ਨਹੀਂ ਕਰਵਾ ਸਕਦੇ ਅਤੇ ਇਲਾਜ ਨਾ ਕਰਾਉਣ ਕਾਰਨ ਅਤੇ ਬਿਮਾਰੀ ਵੱਧ ਜਾਂਦੀ ਹੈ ਅਤੇ ਜਿਸ ਕਾਰਨ ਉਹਨਾਂ ਨੂੰ ਗੰਭੀਰ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸਰਕਾਰ ਨੂੰ ਜਾ ਸਭ ਕੁਝ ਦੇਖਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਨੌਜਵਾਨਾਂ ਦੀ ਮਦਦ ਕਰ ਸਕਦੇ ਹਾਂ ਵੀ ਅਸੀਂ ਬੇਰੁਜ਼ਗਾਰੀ ਕਿਵੇਂ ਖਤਮ ਕਰ ਸਕਦੇ ਹਾਂ ਜਿਸ ਕਾਰਨ ਨੌਜਵਾਨ ਨੇ ਜਿਹੜੇ ਉਹ ਬੇਰੁਜ਼ਗਾਰੀ ਤੋਂ ਛੁਟ ਛੁਟਕਾਰਾ ਪਾਉਣ ਅਤੇ ਸਰਕਾਰ ਨੂੰ ਵੱਧ ਤੋਂ ਵੱਧ ਪੋਸਟਾਂ ਕੱਢਣੀਆਂ ਚਾਹੀਦੀਆਂ ਹਨ ਸਰਕਾਰੀ ਅਹੁਦਿਆਂ ਵਿੱਚ ਵੀ ਜਿਸ ਕਾਰਨ ਬੇਰੁਜ਼ਗਾਰੀ ਖਤਮ ਹੋਵੇ